ਦੇ ਖੇਤਰ ਵਿੱਚ ਵਟਰਨਰੀ ਹਸਪਤਾਲ ਹੈ ਜਿੱਥੇ ਬਹੁਤ ਚੰਗੇ ਸਮਝਦਾਰ ਡਾਕਟਰ ਨਿਯੁਕਤ ਕੀਤੇ ਹੋਏ ਹਨ ਜੋ ਹਰ ਬਿਮਾਰ ਜਾਨਵਰ ਦਾ ਇਲਾਜ ਬੜੇ ਹੀ ਪਿਆਰ ਨਾਲ਼ ਕਰਦੇ ਹਨ ਜਾਨਵਰਾਂ ਨੂੰ ਤੰਦਰੁਸਤ ਰੱਖਣ ਲਈ ਕੈਲਸ਼ੀਅਮ ਵਧੀਆ ਫੀਡ ਸਮੇਂ ਸਿਰ ਘੁੰਮਾਉਣਾ ਆਦਿ ਹਨ ਆਖਰੀ ਵਾਰੀ ਮੇਰੇ ਜਾਨਵਰ ਦੀ ਜਾਂਚ ਉਦੋਂ ਕੀਤੀ ਗਈ ਸੀ ਜਦੋਂ ਉਹਨੇ ਸੂਣਾ ਸੀ ਹਰ ਜਾਨਵਰ ਉੱਤੇ ਅਲੱਗ ਅਲੱਗ ਖਰਚਾ ਹੁੰਦਾ ਹੈ ਇਹਨਾਂ ਵਿੱਚ ਘੋੜੇ ਕੁੱਤੇ ਗਾਵਾਂ ਆਦਿ ਸ਼ਾਮਿਲ ਹਨ ਜਿਨ੍ਹਾਂ ਦਾ ਖਾਣ ਪੀਣ ਸਰੀਰਿਕ ਬਣਤਰ ਅਲੱਗ ਹੈ ਇਸ ਕਰਕੇ ਖਰਚੇ ਦਾ ਅਨੁਮਾਨ ਆਪਾਂ ਨਹੀਂ ਲਾ ਸਕਦੇ ਕਿਉਂਕਿ ਕਿਸੇ 'ਤੇ ਖਰਚਾ ਘੱਟ ਹੁੰਦਾ ਅਤੇ ਕਿਸੇ 'ਤੇ ਖਰਚਾ ਵੱਧ ਹੁੰਦਾ ਹੈ